ਸਾਡੇ ਖੇਤਰ ਵਿੱਚ ਨਵਾਂ ਕੋਈ ਬਿਜ਼ਨਸ ਹੈ ਤਾਂ ਉਹ ਖੇਡ ਕੂਦ ਦਾ ਬਿਜ਼ਨਸ ਕੀਤਾ ਜਾ ਸਕਦਾ ਹੈ ਜਿੱਥੇ ਕਿ ਪਲੇਗਰਾਊਂਡ ਦਿੱਤੇ ਜਾਣ ਕਿਰਾਏ 'ਤੇ ਘੰਟੇ ਜਾਂ ਦੋ ਘੰਟੇ ਦੇ ਹਿਸਾਬ 'ਤੇ ਤਾਂ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਵੀ ਖੇਡ ਖੂਲ ਸਕੇ ਅਤੇ ਤੰਦਰੁਸਤ ਰਹਿ ਸਕੇ ਅਤੇ ਨਾਲ ਹੀ ਨਾਲ ਇਹਦੇ ਨਾਲ ਨਸ਼ਿਆਂ ਤੋਂ ਵੀ ਦੂਰ ਹੋਵੇ ਅਤੇ ਖੇਡ ਦਾ ਵੀ ਇੰਡੋ ਸਟੇਡੀਅਮਸ ਬਣ ਸਕਦੇ ਨੇ ਟੇਬਲ ਟੈਨਿਸ ਅਤੇ ਬੈਡਮਿੰਟਨ ਦੇ ਸਟੇਡੀਅਮਸ ਖੋਲ੍ਹੇ ਜਾ ਸਕਦੇ ਨੇ